ਮੈਂ ਅੰਮ੍ਰਿਤਸਰੀ ਢਾਬੇ ਤੋਂ ਚਾਰ ਰੋਟੀਆਂ ਸ਼ਾਹੀ ਪਨੀਰ ਔਰ ਇੱਕ ਦਾਲ ਦਾ ਓਡਰ ਕੀਤਾ ਸੀ ਮੈੈਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਯਾਦ ਰਹੇਗਾ ਇਸ ਕਰਕੇ ਮੈਂ ਇੱਕ ਐਪ ਡਾਊਨੋਲਡ ਕੀਤੀ ਹੋਈ ਹੈ ਉਸ ਦੇ ਉੱਪਰ ਮੈਂ ਤੁਹਾਡੇ ਡਿਲੀਵਰੀ ਬੋਆਏ ਨੂੰ ਟਰੈਕ ਕਰ ਰਿਹਾਂ ਕਿ ਕਿੱਥੇ ਪਹੁੰਚਿਆ ਹੈ ਅਤੇ ਮੈਂ ਨਾਲ ਦੀ ਨਾਲ ਦੇਖ ਰਿਹਾਂ ਔਰ ਮੈਨੂੰ ਯਕੀਨ ਹੈ ਕਿ ਇਸ ਐਪ ਦੇ ਜ਼ਰੀਏ ਮੈਨੂੰ ਫਾਇਦਾ ਹੋਵੇਗਾ